ਨਮਸਕਾਰ ਜੀ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਸਾਡੇ ਇਲਾਕੇ ਵਿੱਚ ਚਾਰ ਤਰ੍ਹਾਂ ਦੀਆ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਵੇਂ ਕਿ ਮਾਲਵੀ ਪੰਜਾਬੀ ਮੋਗਾ ਪੰਜਾਬੀ ਸਾਡੇ ਪਠਾਨਕੋਟ ਦੀ ਪਠਾਨਕੋਟ ਦੀ ਇਲਾਕੇ ਦੀ ਭਾਸ਼ਾ ਪੰਜਾਬੀ ਚਾਰ ਤਰੀਕੇ ਦੀਆਂ ਪੰਜਾਬੀ ਹੁੰਦੀਆਂ ਹਨ ਅਤੇ ਇਸ ਵਿੱਚ ਹੋਰ ਭਾਸ਼ਾਵਾਂ ਦਾ ਵੀ ਥੋੜ੍ਹਾ ਥੋੜ੍ਹਾ ਫ਼ਰਕ ਪੈਂਦਾ ਹੈ ਜਿਵੇਂ ਕਿ ਡੋਗਰੀ ਅਤੇ ਫਾਰਸੀ ਸਾਡੇ ਇਲਾਕੇ ਦੇ ਲੋਕ ਪੰਜਾਬੀ ਅਤੇ ਡੋਗਰੀ ਮਿਕਸ ਕਰਕੇ ਬੋਲਦੇ ਹਨ ਅਤੇ ਬੋਡੋ ਪੰਜਾਬੀ ਵੀ ਥੋੜ੍ਹੀ ਬਹੁਤ ਬੋਲਦੇ ਹਨ ਕਿਉਂਕਿ ਪੰਜਾਬੀ ਇੱਕ ਐਸੀ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਲੋਕ ਫੈਕਟਰੀਆਂ ਵਿੱਚ ਕੰਮ ਕਰਨ ਲਈ ਆਉਂਦੇ ਹਨ ਤਾਂ ਜੋ ਤਾਂ ਜੋ ਉਹ ਆਪਣੇ ਇਲਾਕੇ ਦੇ ਲੋਕ ਲੋਕ ਜੋ ਭਾਸ਼ਾ ਬੋਲਦੇ ਹਨ ਉਹ ਪੰਜਾਬੀ ਵਿੱਚ ਮਿਕਸ ਕਰ ਕੇ ਬੋਲਦੇ ਹਨ ਅਤੇ ਉਨ੍ਹਾਂ ਨੂੰ ਵੀ ਸਾਡੇ ਇਲਾਕੇ ਦੀ ਭਾਸ਼ਾ ਬੋਲਣੀ ਆ ਜਾਂਦੀ ਹੈ ਧੰਨਵਾਦ